ਅਸੀਂ ਆਪਣੇ ਬਗੀਚੇ ਵਿੱਚ ਵਾਤਾਵਰਨ ਅਤੇ ਜੰਗਲੀ ਜੀਵਾਂ ਦੀਆਂ ਲੋੜਾਂ ਨਾਲ ਆਪਣੇ ਪੌਦਿਆਂ ਦੀਆਂ ਲੋੜਾਂ ਨੂੰ ਇਸ ਤਰ੍ਹਾਂ ਸੰਤੁਲਿਤ ਕਰਦੇ ਹਾਂ ਜਿਵੇਂ ਕਿ ਬਗੀਚਿਆਂ ਵਿੱਚ ਬੂਟਿਆਂ ਨੂੰ ਪਾਣੀ ਸਮੇਂ ਸਿਰ ਦਿੱਤਾ ਜਾਂਦਾ ਹੈ ਉਨ੍ਹਾਂ ਦੀ ਸਮੇਂ ਸਿਰ ਕਟਿੰਗ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਖਾਦ ਅਤੇ ਤੂੜੀ ਸਮੇਂ ਸਿਰ ਦਿੱਤੀ ਜਾਂਦੀ ਹੈ ਅਤੇ ਜੰਗਲੀ ਜੀਵਾਂ ਨੂੰ ਭੋਜਨ ਪ੍ਰਦਾਨ ਕੀਤਾ ਜਾਂਦਾ ਹੈ ਜਿਵੇਂ ਕਿ ਬਾਂਦਰਾਂ ਨੂੰ ਬਾਂਦਰਾਂ ਨੂੰ ਛੋਲੇ ਅਤੇ ਕੁੱਤਿਆਂ ਨੂੰ ਫੀਡ